ਜਿਸ ਤਰ੍ਹਾਂ ਕਿ ਮੈਂ ਨਵਾਂਸ਼ਹਿਰ ਦੀ ਵਸਨੀਕ ਹਾਂ ਅਤੇ ਅ ਮੇਰੇ ਆਲੇ ਦੁਆਲੇ ਕਾਫੀ ਸਾਰੇ ਪਿੰਡ ਨੇ ਜਿਸ ਤਰਾਂ ਓੜ ਹੈ ਕਰਿਆਮ ਕਰੇਹਾ ਮਲਪੁਰ ਸੜੌਆ ਅਤੇ ਇਹਨਾਂ 'ਚ ਮੇਰਾ ਆਏ ਦਿਨ ਕਿਤੇ ਨਾ ਕਿਤੇ ਚੱਕਰ ਲੱਗ ਜਾਂਦਾ ਜਿਸ ਤਰ੍ਹਾਂ ਕਿ ਮੇਰੇ ਰਿਸ਼ਤੇਦਾਰ ਵੀ ਹੈ ਜਿਸ ਤਰ੍ਹਾਂ ਮੇਰੇ ਸਿ ਮੇਰੀ ਸਿਸਟਰ ਰਹਿੰਦੀ ਹੈ ਸੜੋਆ ਅਤੇ ਉੱਥੇ ਵੀ ਮੇਰਾ ਚੱਕਰ ਲੱਗ ਜਾਂਦਾ ਵੈਸੇ ਤਾਂ ਮੈਂ ਦੇਖਿਆ ਕਿ ਸ਼ਹਿਰਾਂ ਨਾਲੋਂ ਜ਼ਿਆਦਾ ਪਿੰਡਾਂ ਵਿੱਚ ਖੁਸ਼ਹਾਲੀ ਹੈ ਕਿਉਂਕਿ ਉੱਥੇ ਪ੍ਰਦੂਸ਼ਣ ਘੱਟ ਹੈ ਉੱਥੇ ਭਾਈਚਾਰਾ ਜ਼ਿਆਦਾ ਆ ਅਤੇ ਪਿੰਡਾਂ ਵਿੱਚ ਜਾ ਕੇ ਨਾ ਬੜਾ ਅੱਛਾ ਲੱਗਦਾ ਮੈਨੂੰ ਅਤੇ ਸਾਡੇ ਨਵਾਂਸ਼ਹਿਰ ਦੇ ਕੋਲ ਹੀ ਰਾਜਾ ਸਾਹਿਬ ਹੈ ਦਾ ਮਜਾਰਾ ਹੈ ਗੁਰਦੁਆਰਾ ਬਹੁਤ ਹੀ ਉਹਦੀ ਮਾਨਤਾ ਹੈ ਬੜੀ ਉਹਦੀ ਪ੍ਰਸਿੱਧੀ ਹੈ ਉੱਥੇ ਵੀ ਜਦੋਂ ਵੀ ਉਹਨਾਂ ਵੱਲੋਂ ਬੁਲਾਵਾ ਆਉਂਦਾ ਅਸੀਂ ਉੱਥੇ ਜ਼ਰੂਰ ਜਾਂਦੇ ਮੱਥਾ ਟੇਕ ਕੇ ਆਉਂਦੇ ਹਾਂ ਅਤੇ ਜਦੋਂ ਵੀ ਵੀਕਐਂਡ 'ਤੇ ਕਿਤੇ ਨਾ ਕਿਤੇ ਪਿੰਡ ਜਾਣ ਦਾ ਮੈਨੂੰ ਮੌਕਾ ਮਿਲਦਾ ਅਤੇ ਮੈਂ ਜ਼ਰੂਰ ਜਾਂਦੀ ਹਾਂ ਚਾਹੇ ਕੋਈ ਫੰਕਸ਼ਨ ਹੋ ਜੇ ਚਾਹੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਾ ਹੋ ਜਾਵੇ ਤਾਂ ਮੈਂ ਜ਼ਰੂਰ ਜਾਂਦੀ ਕਿਉਂਕਿ ਉੱਥੇ ਜਾ ਕੇ ਇੱਕ ਸਕੂਨ ਮਿਲਦਾ ਇੱਕ ਆਨੰਦ ਮਿਲਦਾ ਹੈ ਪਿੰਡਾਂ 'ਚ ਬਹੁਤ ਸ਼ਾਂਤੀ ਹੁੰਦੀ ਏ ਜਿਸ ਤਰ੍ਹਾਂ ਸ਼ਹਿਰਾਂ ਵਿੱਚ ਸਾਰਾ ਦਿਨ ਇੱਕ ਆਵਾਜਾਈ ਦਾ ਰੌਲਾ ਰੱਪਾ ਰਹਿੰਦਾ ਹੈ ਪਰ ਪਿੰਡਾਂ 'ਚ ਇੱਦਾਂ ਦਾ ਕੁਛ ਨਹੀਂ ਹੁੰਦਾ ਪਿੰਡਾਂ ਵਿੱਚ ਹਰੇਕ ਤਰ੍ਹਾਂ ਦੀ ਸ਼ਾਂਤੀ ਮਿਲਦੀ ਆ ਚਾਹੇ ਉਹ ਭਾਈਚਾਰੇ ਦੀ ਹੋਏ ਚਾਹੇ ਉਹ ਆਵਾਜਾਈ ਦੀ ਹੋਏ ਪ੍ਰਦੂਸ਼ਣ ਰਹਿਤ ਹੁੰਦਾ ਆ ਸੋ ਪਿੰਡਾਂ ਦਾ ਦੀ ਇੱਕ ਲਾਈਫ ਨੂੰ ਦੇਖਣਾ ਬਹੁਤ ਜ਼ਰੂਰੀ ਉਹ ਸਾਨੂੰ ਸਭ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ